ਸਰਕਾਰੀ ਸਰਕਾਰੀ ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਅਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜਦੋਂ ਦਵਾਈ ਲੈਣ ਜਾਂਦੇ ਹਾਂ ਤਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਅਤੇ ਸਾਨੂੰ ਟੈਮ ਸਿਰ ਦਵਾਈ ਵੀ ਨਹੀਂ ਮਿਲਦੀ ਦੋ ਢਾਈ ਵੱਜਦੇ ਤੱਕ ਤਿੰਨ ਵੱਜਦੇ ਤੱਕ ਅਸੀਂ ਆ ਸ਼ਾਮ ਨੂੰ ਆਥਣੇ ਘਰ ਦਵਾਈ ਤੋਂ ਵੀ ਸਾਨੂੰ ਮੁੜ ਕੇ ਆਉਣਾ ਪੈਂਦਾ ਅਤੇ ਬਹੁਤ ਕੰਮਾਂ ਦੇ ਵਿੱਚੋਂ ਛੱਡ ਕੇ ਜਾਣਾ ਕੰਮ ਅਤੇ ਬਹੁਤ ਮੁਸ਼ਕਲ ਹੈ ਸਾਨੂੰ ਦੂਜੇ ਦਿਨ ਦੋ ਦੋ ਤਿੰਨ ਤਿੰਨ ਦਿਨ ਸਾਡੇ ਖ਼ਰਾਬ ਹੋ ਜਾਂਦੇ ਆ ਹਸਪਤਾਲਾਂ ਦੇ ਚੱਕਰ ਲਾਉਂਦੇ ਰਹਿੰਦੇ ਹਾਂ ਅਤੇ ਜੇ ਸਾਨੂੰ ਪਹਿਲੇ ਦਿਨ ਦਵਾਈ ਮਿਲ ਜੇ ਤਾਂ ਸਾਨੂੰ ਸਾਡਾ ਟੈਮ ਨਾ ਖ਼ਰਾਬ ਹੋਵੇ ਅਤੇ ਜਿਹੜੇ ਮਰੀਜ਼ ਆ ਬੇਹੋਸ਼ ਵੀ ਹੋ ਜਾਂਦੇ ਹੈ ਲਾਈਨਾਂ ਦੇ ਵਿੱਚ ਖੜ੍ਹੇ ਖੜ੍ਹੇ ਨਹੀਂ ਖੜ੍ਹਿਆ ਜਾਂਦਾ ਅਤੇ ਉਹ ਜਿਹੜੀਆਂ ਬਿਮਾਰੀਆਂ ਹੁੰਦੀਆਂ ਤੇ ਉਹ ਸਮਾਂ ਵੱਧ ਦੀਆਂ ਇੱਕ ਦੂਜੇ ਤੋਂ ਅਤੇ ਇਹਨਾਂ ਬਿਮਾਰੀਆਂ ਦਾ ਛੇਤੀ ਇਲਾਜ ਹੋ ਜੇ ਤਾਂ ਮਰੀਜ਼ ਵੀ ਸੌਖਾ ਜੇ ਸਾਨੂੰ ਦਵਾਈ ਢੰਗ ਨਾਲ ਮਿਲ ਜੇ ਤਾਂ ਸਾਨ ਅਸੀਂ ਆਪ ਵੀ ਸਾਨੂੰ ਮੁਸ਼ਕਲਾਂ ਨਾ ਆਉਣ ਅਤੇ ਨਾ ਸਾਡਾ ਰੋਜ਼ ਰੋਜ਼ ਕੰਮ ਛੁੱਟੇ ਅਤੇ ਅਸੀਂ ਵੀ ਰੋਜ਼ ਜਾਣਾ ਸਾਨੂੰ ਬਹੁਤ ਮੁਸ਼ਕਲ ਹੈ ਤਾਂ ਚੰਗੇ ਇਲਾਜ ਅਤੇ ਚੰਗੇ ਇਹ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਹੈਗੇ ਵਧੀਆ ਹੋਣ ਅਤੇ ਸਾਰੇ ਮਰੀਜ਼ ਜਾ ਕੇ ਉੱਥੋਂ ਹੀ ਦਵਾਈ ਲੈਣ ਤਾਂ ਵਧੀਆ ਮਸਲਾ ਹੱਲ ਹੁੰਦਾ ਸਾਰੀ ਦੁਨੀਆ ਦੇ ਹੁੰਦੇ